ਪੰਜਾਬ ਵਿੱਚ ਲੋਕ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਬਹੁਤ ਵਧੀਆ ਢੰਗ ਨਾਲ ਮਨਾਉਂਦੇ ਹਨ ਆਪਣੀ ਖੁਸ਼ੀ ਜਾਹਿਰ ਕਰਨ ਲਈ ਔਰਤਾਂ ਵੱਲੋਂ ਗਿੱਧਾ ਅਤੇ ਮਰਦਾਂ ਵੱਲੋਂ ਭੰਗੜਾ ਪਾਇਆ ਜਾਂਦਾ ਹੈ ਔਰਤਾਂ ਆਪਣਾ ਗਿੱਧਾ ਪਾਉਣ ਲਈ ਇੱਕ ਗੋਲ ਚੱਕਰ ਵਿੱਚ ਖੜ੍ਹੀਆਂ ਹੋ ਜਾਂਦੀਆਂ ਹਨ ਬੋਲੀ ਪਾਈ ਜਾਂਦੀ ਹੈ ਇਸ ਵਿੱਚ ਕੋਈ ਵੀ ਔਰਤ ਗਿੱਧਾ ਪਾ ਸਕਦੀ ਹੈ ਗਿੱਧੇ ਵਿੱਚ ਹਾਸਾ ਮਜ਼ਾਕ ਵੀ ਹੁੰਦਾ ਹੈ ਗਿੱਧੇ ਵਿੱਚ ਦਿਓਰ ਭਰਜਾਈ 'ਤੇ ਬੋਲੀਆਂ ਪਾਈ ਜਾਂਦੀਆਂ ਹਨ ਛੜੇ ਤੇ ਜੇਠ 'ਤੇ ਵੀ ਬੋਲੀ ਪਾਈ ਜਾਂਦੀ ਹੈ ਔਰ ਸੱਸ ਅਤੇ ਸਹੁਰੇ 'ਤੇ ਵੀ ਬੋਲੀ ਚ ਪਾਈ ਜਾਂਦੀ ਹੈ ਇਸ ਵਿੱਚ ਸੱਸ ਅਤੇ ਸਹੁਰੇ ਨੂੰ ਨਿੰਦਿਆ ਵੀ ਜਾਂਦਾ ਹੈ ਅਤੇ ਉਹਨਾਂ ਦੀ ਸਿਫਤ ਵੀ ਕੀਤੀ ਜਾਂਦੀ ਹੈ ਗਿੱਧੇ ਵਿੱਚ ਹਰੇਕ ਕੋਈ ਅ ਹਰੇਕ ਕੋਈ ਹਿੱਸਾ ਲੈ ਸਕਦਾ ਹੈ ਔਰਤਾਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਗਿੱਧਾ ਪਾਉਂਦੀਆਂ ਹਨ ਪਰ ਅੱਜ ਦੇ ਸਮੇਂ ਵਿੱਚ ਵਿਆਹ ਘਰ ਵਿੱਚ ਨਹੀਂ ਹੁੰਦੇ ਇਸ ਪੈਲਸਾਂ ਵਿੱਚ ਹੁੰਦੇ ਹਨ ਪੈਲਸਾਂ ਵਿੱਚ ਡੀ ਜ਼ੇ ਲਗਵਾਏ ਜਾਂਦੇ ਹਨ ਉੱਥੇ ਨੱਚ ਥੱਕ ਕੇ ਆ ਕੇ ਫਿਰ ਗਿੱਧਾ ਪਾਉਂਦਾ ਪਾਇਆ ਨਹੀਂ ਪਾਇਆ ਜਾਂਦਾ ਇਸ ਲਈ ਔਰਤਾਂ ਨੇ ਪਰ ਅੱਜ ਅਜੇ ਤੱਕ ਵੀ ਗਿੱਧੇ ਨੂੰ ਸਾਂਭਿਆ ਹੋਇਆ ਉਹ ਵਿਆਹ ਤੋਂ ਕੁਛ ਤਿੰਨ ਚਾਰ ਦਿਨ ਪਹਿਲਾਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਗਿੱਧਾ ਪਾਉਂਦੀਆਂ ਹਨ